ਭੱਜਣਾ ਸਰੀਰ ਵਾਸਤੇ ਬਹੁਤ ਹੀ ਲਾਭਦਾਇਕ ਹੈ ਵਰਜਿਸ਼ ਇੱਕ ਮਾਨਸਿਕ ਔਰ ਸਰੀਰਕ ਤੌਰ 'ਤੇ ਤੰਦਰੁਸਤੀ ਵਾਸਤੇ ਬਹੁਤ ਹੀ ਚੰਗੀ ਚੀਜ਼ ਹੈ ਜਦ ਮੈਂ ਛੋਟੀ ਉਮਰ ਵਿੱਚ ਸੀ ਅਜੇ ਤੱਕ ਫੌਜ ਦੇ ਵਿੱਚ ਨਹੀਂ ਗਿਆ ਸੀ ਤਾਂ ਮੈਨੂੰ ਸੁਬ੍ਹਾ ਸੁਬ੍ਹਾ ਉਸ ਟਾਈਮ ਦੌੜਨ ਵਾਸਤੇ ਘੱਟੋ ਘੱਟ ਇੱਕ ਘੰਟਾ ਸਰੀਰ ਦੀ ਵਰਜਿਸ਼ ਜ਼ਰੂਰੀ ਸੀ ਕਿਉਂਕਿ ਮੈਂ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਜਿਸ ਕਰਕੇ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦਾ ਸੀ ਸਰੀਰ ਵਾਸਤੇ ਸਰੀਰ ਦੀ ਵਰਜਿਸ਼ ਤੰਦਰੁਸਤੀ ਬਹੁਤ ਹੀ ਜ਼ਰੂਰੀ ਹੈ ਜਿਸ ਦੇ ਨਾਲ ਮੈਂ ਆਪਣੇ ਸਰੀਰਿਕ ਤੌਰ 'ਤੇ ਫਿੱਟ ਹੋਣ ਕਰਕੇ ਫੌਜ ਦੇ ਵਿੱਚ ਚਲਿਆ ਗਿਆ ਜਿੱਥੇ ਮੈਨੂੰ ਅੱਜ ਵੀ ਮੇਰਾ ਮਨ ਉਮਰ ਦੇ ਹਿਸਾਬ ਨਾਲ ਦੌੜਨ ਵਾਸਤੇ ਸਿਹਤ ਨੂੰ ਤੰਦਰੁਸਤ ਰੱਖਦਾ ਦੌੜਨ ਵਾਸਤੇ ਹੁਣ ਓਨਾ ਭੱਜਿਆ ਤਾਂ ਖੈਰ ਨਹੀਂ ਜਾਂਦਾ ਪਰ ਫੇਰ ਵੀ ਆਪਣੇ ਸਰੀਰ ਨੂੰ ਔਰ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਮੈਂ ਤੜਕੇ ਚਾਰ ਵਜੇ ਉੱਠ ਕੇ ਪੰਜ ਵਜੇ ਤੱਕ ਰੋਡ ਵਾਕ ਜ਼ਰੂਰ ਕਰਦਾ ਹਾਂ ਜਿਸ ਦੇ ਨਾਲ ਮੇਰਾ ਸਰੀਰ ਬਿਲਕੁਲ ਸਹੀ ਹੈ ਤੰਦਰੁਸਤ ਹੈ ਮੈਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਜਾਂ ਕਿਸੇ ਹਸਪਤਾਲ ਤੋਂ ਕੋਈ ਵੀ ਮਦਦ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਸਿਰਫ ਆਪਣੇ ਸਰੀਰ ਦੇ ਵਿੱਚੋਂ ਪਸੀਨਾ ਵਹਾਉਣਾ ਔਰ ਖੂਨ ਵਹਾ ਬਚਾਉਣਾ ਇਹ ਫੌਜ ਦਾ ਪਹਿਲੋਂ ਪਹਿਲਾ ਜਿਸ ਨਾਲ ਬੰਦੇ ਦੀ ਤੰਦਰੁਸਤੀ ਵੱਧਦੀ ਹੈ ਮਜ਼ਬੂਤ ਰਹਿੰਦਾ ਹੈ ਸਰੀਰ ਤਕੜਾ ਰਹਿੰਦਾ ਹੈ ਔਰ ਖਾਣਾ ਪੀਣਾ ਸਹੀ ਹਜ਼ਮ ਹੋ ਜਾਂਦਾ ਹੈ ਇਸ ਕਰਕੇ ਸਿਹਤ ਵਾਸਤੇ ਤੰਦਰੁਸਤੀ ਬਹੁਤ ਜ਼ਰੂਰੀ ਹੈ ਔਰ ਤੜਕੇ ਦੌੜਨਾ ਚਾਹੀਦਾ ਹੈ ਪਰ ਉਮਰ ਦੇ ਹਿਸਾਬ ਨਾਲ ਹੁਣ ਐਨੀ ਦੌੜ ਭੱਜ ਨਹੀਂ ਹੋ ਸਕਦੀ